ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂਜੀ ਮੈਡਮ ਇਹਦਾ ਬੱਚੇ ਦਾ ਟੈਸਟ ਹੋਇਆ ਤਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਪੜ੍ਹਨ ਦੇ ਵਿੱਚ ਟੈਸਟ ਕਿੱਦਾਂ ਮਤਲਬ ਫਸਟ ਐਕਸਪੀਰੀਐਂਸ ਸੀ ਜੀ ਇਹਦਾ ਹਾਂਜੀ ਪੜ੍ਹਾਈ ਦੇ ਵਿੱਚ ਕਿਵੇਂ ਹੈ ਜੀ ਪੜ੍ਹਾਈ ਦੇ ਵਿੱਚ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹਦੇ ਲਈ ਸੌਰੀ ਜੀ ਮੈਂ ਕਿਤੇ ਬਾਹਰ ਚਲਿਆ ਗਿਆ ਸੀ ਜੀ ਤਾਂ ਕਰਕੇ ਪੀ ਟੀ ਐੱਮ ਅਟੈਂਡ ਨਹੀਂ ਕਰ ਪਾਇਆ ਹਾਂਜੀ ਹਾਂਜੀ ਹਾਂਜੀ ਟਿਊਸ਼ਨ ਦੀ ਲੋੜ ਤਾਂ ਨਹੀਂ ਮੈਡਮ ਟਿਊਸ਼ਨ ਰੱਖਣ ਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਘਰ ਕੋਸ਼ਿਸ਼ ਕਰਾਂਗੇ ਜੀ ਵੀ ਅਸੀਂ ਪੜ੍ਹਾ ਸਕੀਏ ਇਹਨੂੰ ਵੈਸੇ ਵੈਸੇ ਤਾਂ ਠੀਕ ਹੈ ਮੈਡਮ ਜੀ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਮਤਲਬ ਪੜ੍ਹਾਈ ਦੇ ਵਿੱਚ ਕਿਉਂਕਿ ਹਲੇ ਛੋਟੀ ਕਲਾਸ ਹੈ ਫਿਰ ਉਹ ਤੋਂ ਬਾਅਦ ਬੜੀ ਕਲਾਸਾਂ ਵਿੱਚ ਦਿੱਕਤ ਆਵੇ ਬਾਅਦ 'ਚ ਹਾਂਜੀ ਚਲੋ ਠੀਕ ਠੀਕ ਹੈ ਮੈਡਮ ਜੀ ਸ਼ੁਕਰੀਆ ਜੀ ਧੰਨਵਾਦ ਉਕੇ